ਹੈਲੋ ਸਰ ਸਵਿਗੀ ਤੋਂ ਬੋਲਦੇ ਪਏ ਤੁਸੀਂ ਅਸੀਂ ਨਾ ਪੀਜ਼ਾ ਔਡਰ ਕੀਤਾ ਸੀਗਾ ਤੁਹਾਡਾ ਪੀਜ਼ਾ ਅਜੇ ਤੱਕ ਪਹੁੰਚਿਆ ਨਹੀਂ ਆ ਅਤੇ ਇਸ ਕਰ ਕੇ ਅਸੀਂ ਤੁਹਾਨੂੰ ਮੇਰਾ ਅਡਰੈਸ ਹੈਗਾ ਵਾ ਭੱਲਾ ਕਲੋਨੀ ਬਿਲਡਿੰਗ ਨੰਬਰ ਹੈਗਾ ਵਾ ਪੰਦਰਾਂ ਅਤੇ ਦੂਸਰੇ ਫਲੋਰ 'ਤੇ ਅਸੀਂ ਉੱਪਰ ਰਹਿੰਦੇ ਹਾਂ ਫਲੈਟ ਨੰਬਰ ਗਿਆਰਾਂ ਵਾ ਅਤੇ ਸਰ ਤੁਹਾਨੂੰ ਥੋੜ੍ਹੀ ਜਿਹੀ ਨਾ ਮੈਂ ਹਿਟ ਦਿੰਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਪਹੁੰਚ ਸਕਦੇ ਜੇ ਸਾਡੇ ਕੋਲ ਸਾਡੇ ਘਰ ਦਾ ਅਡਰੈੱਸ ਥੋੜ੍ਹਾ ਤੁਸੀਂ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਆਉਂਦੇ ਹੋ ਫਿਰ ਤੁਸੀਂ ਝਬਾਲ ਨੂੰ ਆਉਣਾ ਹੈ ਝਬਾਲ ਤੋਂ ਤੁਸੀਂ ਬੀੜ ਬਾਬਾ ਬੁੱਢਾ ਸਾਹਿਬ ਜੀ ਨੂੰ ਮੁੜਨਾ ਵਾ ਬਹੁਤ ਮਸ਼ਹੂਰ ਆ ਗੁਰਦੁਆਰਾ ਸਾਹਿਬ ਉਹ ਬਾਬਾ ਬੁੱਢਾ ਸਾਹਿਬ ਜੀ ਦਾ ਉਹਦੇ ਲਾਗੇ ਇੱਕ ਨਾ ਬਣੀ ਹੋਈ ਆ ਪਾਰਕ ਬਣੀ ਹੋਈ ਆ ਬਹੁਤ ਸੋਹਣੀ ਉਹਦੇ ਲਾਗੇ ਤੁਸੀਂ ਸੱਜੇ ਪਾਸੇ ਨੂੰ ਮੁੜ ਜਾਣਾ ਵਾ ਸੱਜੇ ਪਾਸੇ ਤੋਂ ਮੁੜ ਕੇ ਥੋੜ੍ਹਾ ਤੁਸੀਂ ਅੱਗੇ ਆਉਣਾ ਹੈ ਅੱਧਾ ਕੁ ਕਿਲੋਮੀਟਰ ਅੱਗੇ ਨੂੰ ਚਲਣਾ ਹੈ ਉਸ ਤੋਂ ਬਾਅਦ ਥੋੜ੍ਹਾ ਅੱਗੇ ਆਣ ਕੇ ਉਹ ਖੱਬੇ ਨੂੰ ਥੋੜ੍ਹਾ ਹੋ ਕੇ ਨਾਲ ਹੀ ਥੋੜ੍ਹਾ ਜਿਹਾ ਉੱਥੇ ਨਾ ਸਾਡਾ ਬਿਲਡਿੰਗ ਹੈਗੀ ਆ ਉੱਥੇ ਤੁਸੀਂ ਆਣ ਕੇ ਅਤੇ ਮੇਰਾ ਪੀਜਾ ਜਿਹੜਾ ਅਸੀਂ ਤੁਹਾਨੂੰ ਔਡਰ ਕੀਤਾ ਹੋਇਆ ਪਲੀਜ਼ ਉਹ ਪਹੁੰਚਾ ਦਿਓ ਥੋੜ੍ਹਾ ਜਲਦੀ ਕਰਕੇ ਬਹੁਤ ਮਿਹਰਬਾਨੀ ਹੋਵੇਗੀ ਤੁਹਾਡੀ ਸਰ